ਬਹੁਤ ਸਾਰੇ ਰਿਹਾਇਸ਼ੀ ਵਿਕਲਪ ਹਨ ਜੋ ਸਾਡੇ ਰੂਪਨਗਰ ਜ਼ਿਲ੍ਹੇ ਵਿੱਚ ਆਸਾਨੀ ਨਾਲ ਮਿਲ ਜਾਂਦੇ ਹਨ ਜੇਕਰ ਮੈਂ ਗੱਲ ਕਰਾਂ ਰੀਅਲ ਇਸਟੇਟ ਦੀ ਤਾਂ ਅੱਜ ਕੱਲ੍ਹ ਲੋਕ ਜੋ ਹਨ ਬਹੁਤ ਸਾਰੇ ਫਲੈਟਸ ਬਣਾ ਕੇ ਉਸਨੂੰ ਅੱਗੇ ਸੇਲ ਕਰਨ ਵਿੱਚ ਬਹੁਤ ਆਪਣਾ ਮੁਨਾਫਾ ਸਮਝਦੇ ਹਨ ਅਤੇ ਉਸਨੂੰ ਇੱਕ ਆਪਣੇ ਕਾਰੋਬਾਰ ਵਜੋਂ ਵੀ ਉਹਨਾਂ ਨੇ ਅੱਗੇ ਵਧਾਇਆ ਹੈ ਜੇ ਇਸ ਤੋਂ ਇਲਾਵਾ ਗੱਲ ਕਰਾਂ ਤਾਂ ਬਹੁਤ ਸਾਰੇ ਹੋਰ ਵਿਕਲਪ ਹਨ ਜਿਵੇਂ ਕਿ ਲੋ ਲੋਕ ਆਪਣੇ ਘਰਾਂ ਦੇ ਹੀ ਉੱਪਰ ਦੂਸਰੇ ਮੰਜ਼ਿਲ ਤੀਸਰੇ ਮੰਜ਼ਿਲ ਦੇ ਨੂੰ ਕਿਰਾਏ 'ਤੇ ਚੜ੍ਹਾ ਕੇ ਲੋਕ ਦੂਸਰੇ ਲੋਕਾਂ ਦੇ ਰਿਹਾਇਸ਼ ਦਾ ਇੱਕ ਜ਼ਰੀਆ ਬਣਾਉਂਦੇ ਹਨ ਅਤੇ ਉਸ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਫਾਇਦਾ ਹੁੰਦਾ ਹੈ ਕਈ ਲੋਕ ਤਾਂ ਆਪਣਾ ਜਿਵੇਂ ਕਿ ਇਕੱਲੇ ਰਹਿੰਦੇ ਹਨ ਤਾਂ ਕਰਕੇ ਉਹ ਕਿਰਾਏਦਾਰ ਚੜ੍ਹਾਉਣਾ ਚਾਹੁੰਦੇ ਹਨ ਇਸ ਨਾਲ ਉਹਨਾਂ ਨੂੰ ਇੱਕ ਭਰਿਆ ਭੁਰਿਆ ਘਰ ਮਿਲ ਜਾਂਦਾ ਹੈ ਅਤੇ ਰੌਣਕ ਵੀ ਮਿਲ ਜਾਂਦੀ ਹੈ ਜੇਕਰ ਕਿਰਾਏ ਦੀ ਗੱਲ ਕਰੀਏ ਤਾਂ ਆਮ ਲੋਕਾਂ ਲਈ ਕਿਰਾਇਆ ਇੱਥੇ ਬਹੁਤ ਹੀ ਘੱਟ ਹੈ ਆਰਾਮ ਨਾਲ ਲੋਕ ਇਸਦਾ ਲੁਤਫ ਉਠਾ ਸਕਦੇ ਹਨ ਜਿਵੇਂ ਕਿ ਮੈਂ ਗੱਲ ਕਰਾਂ ਜੇ ਇੱਕ ਤੋਂ ਦੋ ਲੋਕਾਂ ਲਈ ਕਮਰੇ ਦੀ ਜ਼ਰੂਰਤ ਹੈ ਤਾਂ ਪੰਦਰ੍ਹਾਂ ਤੋਂ ਦੋ ਹਜ਼ਾਰ ਦੇ ਵਿੱਚ ਦਾ ਕਿਰਾਇਆ ਆਰਾਮ ਨਾਲ ਮਿਲ ਜਾਂਦਾ ਉਹਨਾਂ ਨੂੰ ਅਤੇ ਇਹ ਉਹਨਾਂ ਲਈ ਆਸਾਨ ਹੁੰਦਾ ਹੈ ਦੇ ਦੇਣਾ ਅਤੇ ਇਸ ਤੋਂ ਵਜੋਂ ਜੇ ਦੂਸਰੀ ਜਗ੍ਹਾਵਾਂ ਤੋਂ ਲੋਕ ਇ ਰੂਪਨਗਰ ਵਿੱਚ ਸਿੱਖਿਆ ਜਾਂ ਕਿਸੇ ਹੋਰ ਕੰਮਕਾਰ ਵਜੋਂ ਆਉਂਦੇ ਹਨ ਅਤੇ ਉਹ ਉਹਨਾਂ ਨੂੰ ਰਿਹਾਇਸ਼ੀ ਦੀ ਜ਼ਰੂਰਤ ਪੈਂਦੀ ਹੈ ਤਾਂ ਆਸਾਨੀ ਨਾਲ ਉਹਨਾਂ ਨੂੰ ਘਰ ਅਤੇ ਕੁਆਰਟਰਸ ਵੀ ਮਿਲ ਜਾਂਦੇ ਹਨ